ਸਾਡੇ ਇਲਾਕੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਵਰਕਰ ਹਨ ਆਮ ਆਦਮੀ ਪਾਰਟੀ ਨੇ ਆ ਕੇ ਕਾਫੀ ਕਰੱਪਸ਼ਨ ਨੂੰ ਹੁੱਕ ਠੱਲ ਪਾਈ ਹੈ ਪਹਿਲਾਂ ਕਾਂਗਰਸੀ ਵਰਕਰਾਂ ਦੇ ਸਮੇਂ ਕਾਫੀ ਮੁਸ਼ਕਲ ਕੰਮ ਹੋਏ ਸਨ ਅਤੇ ਉਸ ਸਮੇਂ ਕਰੱਪਸ਼ਨ ਜ਼ਿਆਦਾ ਸੀ